ਪੰਜਾਬ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਅਤੇ ਜਿਨ੍ਹਾਂ ਵਿੱਚੋਂ ਮੈਨੂੰ ਕਬੱਡੀ ਖੇਡ ਸਾਰਿਆਂ ਨਾਲੋਂ ਵਧੀਆ ਦੇਖਣੀ ਅਤੇ ਖੇਡਣੀ ਲੱਗਦੀ ਹੈ ਇੱਕ ਤਾਂ ਇਹ ਸਾਡੇ ਇਤਿਹਾਸ ਨਾਲ ਸੰਬੰਧਿਤ ਹੈ ਦੂਸਰੀ ਇਹਦੇ ਵਿੱਚ ਖੇਡਣ ਵਾਲੇ ਦੇ ਨਾਲ ਨਾਲ ਦੇਖਣ ਵਾਲੇ ਨੂੰ ਵੀ ਬਹੁਤ ਜ਼ਿਆਦਾ ਜੋਸ਼ ਆ ਜਾਂਦਾ ਹੈ ਪੁਰਾਣੇ ਟਾਈਮਾਂ ਤੋਂ ਅਸੀਂ ਅਸੀਂ ਦੇਖਦੇ ਹਾਂ ਜਿਵੇਂ ਕਿ ਪੰਜਾਬ ਦੇ ਪੁਰਾਣੇ ਤੋਂ ਪੁਰਾਣੇ ਬਜ਼ੁਰਗਾਂ ਦੇ ਸਰੀਰ ਬਹੁਤ ਜ਼ਿਆਦਾ ਵਧੀਆ ਅਤੇ ਫਿੱਟ ਸੀ ਕਿਉਂਕਿ ਉਹ ਉਹਨਾਂ ਟਾਈਮਾਂ ਵਿੱਚ ਵੀ ਕਬੱਡੀ ਦਾ ਪੂਰਾ ਆਨੰਦ ਮਾਣਦੇ ਸੀ ਜਿਸ ਕਰਕੇ ਉਹਨਾਂ ਦੇ ਸਰੀਰ ਬਹੁਤ ਜ਼ਿਆਦਾ ਫਿੱਟ ਸੀ ਇਸ ਕਰਕੇ ਵੀ ਮੈਨੂੰ ਕਬੱਡੀ ਦੇਖਣੀ ਅਤੇ ਖੇਡਣੀ ਬਹੁਤ ਪਸੰਦ ਹੈ ਅਸੀਂ ਦੇਖਦੇ ਹਾਂ ਕਿ ਕਿ ਪੰਜਾਬ ਦੇ ਵਿੱਚ ਥਾਂ ਥਾਂ 'ਤੇ ਕਬੱਡੀ ਦੇ ਟੂਰਨਾਮੈਂਟ ਕਰਵਾਏ ਜਾਂਦੇ ਹਨ ਜਿਸ ਕਰਕੇ ਪੰਜਾਬ ਦੇ ਨੌਜਵਾਨਾਂ ਵਿੱਚ ਉਤਸ਼ਾਹ ਦਾ ਮਾਹੌਲ ਬਣਿਆ ਰਹਿੰਦਾ ਹੈ ਜਿਸ ਨਾਲ ਕਿ ਪੰਜਾਬ ਦੇ ਨੌਜਵਾਨ ਫਿੱਟ ਅਤੇ ਨਸ਼ਿਆਂ ਤੋਂ ਦੂਰ ਰਹਿ ਸਕਦੇ ਹਨ ਇਸ ਕਰਕੇ ਵੀ ਮੈਨੂੰ ਕਬੱਡੀ ਬਹੁਤ ਪਸੰਦ ਹੈ ਕਬੱਡੀ ਵਿੱਚ ਦੋ ਟੀਮਾਂ ਹੁੰਦੀਆਂ ਹਨ ਜਿਨ੍ਹਾਂ ਦੇ ਅੱਠ ਅੱਠ ਪਲੇਅਰ ਹੁੰਦੇ ਹਨ ਅਤੇ ਇੱਕ ਕਬੱਡੀ ਦੇ ਪਲੇਅਰ ਨੇ ਦੂਸਰੀ ਟੀਮ ਦੇ ਘੇਰੇ ਵਿੱਚ ਜਾ ਕੇ ਉਹਨਾਂ ਦੇ ਜਿੰਨੇ ਵੱਧ ਤੋਂ ਵੱਧ ਪੁਆਇੰਟ ਹੋ ਸਕਦੇ ਹਨ ਓਨੇ ਲੈ ਕੇ ਆਉਣੇ ਹੁੰਦੇ ਹਨ ਅਤੇ ਜਿਸ ਟੀਮ ਦੇ ਪੁਆਇੰਟ ਸਾਰਿਆਂ ਨਾਲੋਂ ਜ਼ਿਆਦਾ ਹੁੰਦੇ ਹਨ ਅਤੇ ਉਹ ਟੀਮ ਜੇਤੂ ਹੁੰਦੀ ਹੈ ਜਿਸ ਦੇ ਨਾਲ ਖਿਡਾਰੀਆਂ ਦੀ ਸਿਹਤ ਅਤੇ ਸਿਹਤ ਅਤੇ ਸਰੀਰ ਸਰੀਰਕ ਤੌਰ 'ਤੇ ਬਹੁਤ ਜ਼ਿਆਦਾ ਫਿੱਟ ਹੁੰਦੇ ਹਨ ਇਸ ਲਈ ਮੈਨੂੰ ਕਬੱਡੀ ਖੇਡਣੀ ਬਹੁਤ ਪਸੰਦ ਹੈ ਅਸੀਂ ਪੰਜਾਬ ਵਿੱਚ ਦੇਖਦੇ ਹਾਂ ਕਿ ਜਿੱਥੇ ਵੀ ਮੇਲੇ ਹੁੰਦੇ ਹਨ ਉੱਥੇ ਕਬੱਡੀ ਦੇ ਟੂਰਨਾਮੈਂਟ ਜ਼ਰੂਰ ਕਰਵਾਏ ਜਾਂਦੇ ਹਨ ਜਿਸ ਨਾਲ ਕਿ ਮੇਲੇ ਦਾ ਮਾਹੌਲ ਬਹੁਤ ਜ਼ਿਆਦਾ ਵਧੀਆ ਬਣਿਆ ਰਹਿੰਦਾ ਹੈ ਪੁਰਾਣੇ ਟਾਈਮਾਂ ਤੋਂ ਦੇਖਦੇ ਹਾਂ ਕਿ ਅਸੀਂ ਸਾਡੇ ਇੱਥੇ ਬਹੁਤ ਜ਼ਿਆਦਾ ਪਲੇਅਰ ਜਿਵੇਂ ਕਿ ਦੁੱਲਾ ਭੱਟੀ ਹੋ ਗਿਆ ਹੈਂ ਜਸਵਿੰਦਰ ਭੱਟੀ ਹੋ ਗਿਆ ਇਹ ਜ਼ਿਆਦਾ ਸਾਡੇ ਇਲਾਕੇ ਦੇ ਬਹੁਤ ਹੀ ਮੰਨੇ ਪ੍ਰਮੰਨੇ ਖਿਡਾਰੀ ਹਨ ਜਿਨ੍ਹਾਂ ਕੋਲ ਇਨਾਮ ਵਿੱਚ ਇਨ੍ਹਾਂ ਨੇ ਬਹੁਤ ਚੀਜ਼ਾਂ ਜਿੱਤੀਆਂ ਹੋਈਆਂ ਹਨ ਜਿਸ ਕਰਕੇ ਇਹਨਾਂ ਦਾ ਨਾਮ ਬਣਿਆ ਹੈ ਅਸੀਂ ਦੇਖਦੇ ਹਾਂ